ਸੇਬ ਕੇਲਾ ਸੰਤਰਾ ਆਮ ਅੰਗੂਰ ਅਨਾਨਾਸ ਪਪੀਤਾ ਤਰਬੂਜ ਸਟਾਵੇਰੀ ਆਲੂਵੇਰਾ ਬਲੂਬੇਰੀ ਗਾਜਰ ਆਲੂ ਟਮਾਟਰ ਪਿਆਜ਼ ਬੰਦ ਗੋਭੀ ਪਾਲਕ ਫੁੱਲ ਗੋਭੀ ਬਰੋਕਲੀ ਸ਼ਿਮਲਾ ਮਿਰਚ ਬੈਂਗਨ ਦੁੱਧ ਪਨੀਰ ਮੱਖਣ ਦਹੀ ਘੀ ਅੰਨ ਚੌਲ ਗੇਹੂੰ ਮਕਈ ਜੋਂ ਦਾਲੀ ਦਲੀਆ ਚਣੇ ਮਸੁਰ ਦੀ ਦਾਲ ਮੂੰਗ ਦੀ ਦਾਲ ਰਾਜਮਾਂਹ ਕਾਲੇ ਚਣੇ ਮਟਰ ਚਿਕਨ ਮਟਨ ਮੱਛੀ ਚੀੰਗਾ ਹਲਦੀ ਜੀਰਾ ਧਨੀਆ ਲਵੰਗ ਇਲਾਚੀ ਦਾਲ ਚੀਨੀ ਪੁਦੀਨਾ ਬੇਜੀਲ ਅਰੇ ਅਰੇ ਓਰੇਗਾਨੋ ਰੋਟੀ ਕੇਕ ਬਿਸਕੁਟ ਮਫ਼ੀਨ ਡੋਨਟ ਪੀਜਾ ਬਰਗਰ ਸੈਂਡਵਿਚ ਨੂਡਲ ਫਰੈਂਡ ਫਰੈਂਚ ਫਲਾਈਡੀਜ ਸਮੋਸਾ ਗੋਲ ਗੱਪੇ ਮੋਮਸ ਪਕੌੜਾ ਆਈਸਕ੍ਰੀਮ ਗੁਲਾਬ ਜਾਮਨ ਰਸਗੁੱਲਾ ਚਾਗਲੇਟ ਹਲਵਾ ਚਾਹ ਕਾਫੀ ਰਸ ਮਿਲਕ ਸ਼ੇਕ ਸਮੂਦੀ ਧੰਨਵਾਦ